ਹਾਂਜੀ ਹੈਲੋ ਹਾਂਜੀ ਹਾਂਜੀ ਬੋਲੋ ਐਥੀ ਆ ਘਰ ਦੀ ਕੋਲੇ ਆ ਦੱਸੋ ਅੱਛਾ ਓ ਯਾਰ ਮੈਂ ਬੰਦੇ ਨੂੰ ਕਿਹਾ ਐ ਉਹ ਬੰਦੇ ਦਾ ਪਤਾ ਹੀ ਕੀ ਅੱਜ ਕੱਲ ਬਿਜ਼ੀ ਹੈਗੇ ਥੋੜੇ ਜਿਹੇ ਮੈਂ ਉਹਨੂੰ ਕਿਹਾ ਸੀਗਾ ਸਾਰਾ ਵੇਖਣ ਆਵੇਗਾ ਸ਼ਾਮ ਨੂੰ ਤੇ ਉਸ ਤੋਂ ਬਾਅਦ ਉਹ ਸਾਰਾ ਆਪਣਾ ਸਮਾਨ ਕੱਢ ਕੇ ਖਾਸ ਕਰਕੇ ਜਿਹੜਾ ਯੂਜ ਦਾ ਸਮਾਨ ਇਹ ਰੱਖ ਲੇਗਾ ਬਾਕੀ ਜਿਹੜਾ ਸਮਾਨ ਹ ਉਹ ਕਹਿੰਦਾ ਆਪਾਂ ਸਿਟ ਦਿਆਂਗੇ ਜਾਂ ਕੋਈ ਕਬਾੜ ਚ ਖਾ ਜਾਗੇ ਕਮਰਾ ਇਕਦਮ ਫਿਸ਼ ਕਰ ਦਿਆਂਗੇ ਵਧੀਆ ਫਸਕਲਾਸ ਤੇ ਉਹ ਪਰ ਟਾਈਮ ਲੱਗੇਗਾ ਉਹ ਆਮ ਕਿਸ ਵੇਲੇ ਇਹ ਵੇਖੋ ਆਪਾਂ ਤੁਹਾਨੂੰ ਕਿਹਾ ਹੀ ਹੈ ਇੱਕ ਤਰ੍ਹਾਂ ਦਾ ਟੈਸਟ ਐ ਉਹ ਹੈ ਤਾਂ ਮੁਸ਼ਕਿਲ ਪਿਆ ਪਰ ਹੁਣ ਮੈਂ ਤਾਂ ਵਿਚਾਰੇ ਨੂੰ ਕਹਿ ਆ ਦੋ ਵਾਰੀ ਉਹਦੇ ਘਰੇ ਵੀ ਹੋਇਆ ਆ ਤੇ ਉਹ ਇੱਕ ਤਾਂ ਉਹਦਾ ਭਰਾ ਬਾਹਰ ਗਿਆ ਸੀਗਾ ਤੇ ਨਾਲ ਆਣਾ ਸੀ ਉਹਦੇ ਉਦੋ ਆਵਾਂਗੇ ਤੇ ਇਕ ਉਹਦੇ ਕੋਲ ਜਿਹੜੀ ਆ ਰਕਸ਼ਾ ਸਹੀ ਸਮਾਨ ਚੱਕਣ ਵਾਲੀ ਰੱਖਣ ਵਾਲੀ ਉਹ ਖਰਾਬ ਹੋ ਜਾਂਦੀ ਸੀ ਹੁੰਦੀ ਹਾਂ ਤਾਂ ਕਰਕੇ ਨਾ ਉਥੋ ਟਾਈਮ ਲੱਗੇਗਾ ਤੇ ਉਹ ਕਹਿੰਦਾ ਸੀ ਤੁਸੀਂ ਪੋੜੀ ਪੂੜੀ ਵੀ ਲਿਆ ਕੇ ਰੱਖੋ ਕੁਛ ਹੋਰ ਵੀ ਕਰੋ ਉਹ ਵੀ ਲਿਆਓ ਆਪਣਾ ਇੱਕ ਘੋੜੀ ਲੈ ਆਓ ਪੌੜੀ ਲੈ ਆਓ ਸਾਰੇ ਕੰਧਾਂ ਕੁੰਧਾਂ ਵੀ ਸਾਫ ਕਰ ਦਿਆਂਗਾ ਕਲੀ ਕੁਲੀ ਵੀ ਕਰ ਦਿਆਂਗੀ ਉਹਨੂੰ ਜਿੱਥੋਂ ਕੋੀ ਮਾੜੀ ਮੋਟੀ ਟੀਮ ਉਖੜੀ ਹੋਈ ਉਹ ਵੀ ਕਰ ਦਿਆਂਗੇ ਸਾਰਾ ਕੁਛ ਉਹ ਕਹਿੰਦਾ ਵਧੀਆ ਕਰ ਦਿਆਂਗਾ ਬਾਕੀ ਹੋਰ ਔਰ ਹੋਰ ਜਿਹੜਾ ਕੰਮ ਹੈਗਾ ਸੀ ਆਪਣੇ ਉਹ ਫਰਿਜ ਦਾ ਯਾਰ ਮੈਂ ਉਹ ਉਸਦੀ ਕੰਪਨੀਆਂ ਨੂੰ ਕੀਤਾ ਫੋਨ ਉਹ ਕਹਿੰਦੇ ਨੇ ਅਸੀਂ ਬੰਦਾ ਭੇਜਾਂਗੇ ਹੁਣ ਕੰਪਨੀਆਂ ਆਲੇ ਬੰਦਾ ਭੇਜਦੇ ਨੇ ਉਹਨਾਂ ਨੂੰ ਆਨਲਾਈਨ ਮੈਂ ਸ਼ਿਕਾਇਤ ਵੀ ਉਹ ਪਾਈ ਹੋਈ ਏ ਕੰਪਲੇਟ ਵੀ ਪਾਈ ਹੋਈ ਹ ਉਹ ਆਪਣਾ ਅਜੇ ਗਰੰਟੀ ਪੀਰੀਅਡ 'ਚ ਹੈਗਾ ਤੇ ਆਨਲਾਈਨ ਉਨੂੰ ਉਹਨੂੰ ਕਿਹਾ ਹਾਂ ਅਤੇ ਉਹ ਨਹੀਂ ਉਹ ਆਣਗੇ ਤਾਂ ਸਹੀ ਪਰ ਉਹਨਾਂ ਨੇ ਆਪਣੇ ਹਿਸਾਬ ਨਾਲ ਆਣਾ ਨਾ ਜਿਵੇਂ ਉਹਨੂੰ ਕਮੈਂਟਾਂ ਹੁੰਦੀਆਂ ਨੇ ਉਹ ਕੰਪਲੇਂਟ ਨੂੰ ਜਦੋਂ ਕਲੀਅਰ ਹੋਵੇਗੀ ਉਹਦਾ ਉਹ ਸਾਧਨ ਆਣਗੇ ਉਹਦਾ ਜਿਵੇਂ ਆਪਣੀ ਵਾਰੀ ਆਏਗੀ ਹੋਰ ਤਾਂ ਹੋਰ ਤਾਂ ਕੋਈ ਨੀ ਕੀ ਉਹ ਜਿਵੇਂ ਫਰਿੱਜ ਦਾ ਉੱਤੇ ਸਟੈਪਲਾਈਜਰ ਆਪਾਂ ਲਵਾਣਾ ਐ ਉਹ ਕਹਿੰਦਾ ਸਟੈਪਲੇਜਰ ਲਵਾ ਲੋ ਵੀ ਗਰਮੀਆਂ ਦੇ ਵਿੱਚ ਥੋਨੂੰ ਮੁਸ਼ਕਿਲ ਨੀ ਆਏਗੀ ਜਦੋਂ ਲਾਈਟ ਘੱਟ ਆਉਂਦੀ ਐ ਲਾਈਟ ਵੀ ਪੂਰੀ ਆਵੇਗੀ ਤੇ ਕੂਲਿੰਗ ਵੀ ਪੂਰੀ ਹੋਵੇਗੀ ਓਕੇ ਓਕੇ ਕਰਾ ਦੇ ਕਰਾ ਦਿਆਂਗੇ ਠੀਕ ਐ ਓਕੇ ਓਕੇ ਓਕੇ